ਹਾਂਜੀ ਕਿਵੇਂ ਹੋ ਹੋਰ ਬੱਚੇ ਕਿਵੇਂ ਨੇ ਐਡਮਿਸ਼ਨ ਕਰਵਾਉਣਾ ਸੀ ਬੱਚਿਆਂ ਦਾ ਕਿੱਥੇ ਕਰਵਾਈਏ ਕਿਹੜਾ ਸਕੂਲ ਬੈਸਟ ਆ ਆਪਣੇ

ਅੱਛਾ

ਫੈਸਿਲਿਟੀ ਕੀ ਕੀ ਨੇ ਉੱਥੇ ਅੱਛਾ ਜੀ ਹੋਰ ਅੱਛਾ ਅਤੇ ਹੋਰ ਕੋਈ ਪਲੇਅਗਰਾਉਂਡ ਵਗੈਰਾ ਕੇ ਗੇਮਜ਼ ਕੋਈ ਐਕਸਟਰਾ ਗੇਮਜ਼ ਹੈਗੀਆਂ ਨੇ ਐਕਸਟਰਾ ਵੀ ਕੋਈ ਗੇਮ ਬੱਚੇ ਨੂੰ ਆਪਾਂ ਗੇਮ ਦੇ ਵਿੱਚ ਪਾਉਣਾ ਹੋਵੇ ਅੱਛਾ ਅੱਛਾ ਹਾਂ ਪੀ ਪੀ ਐੱਸ ਅੱਛਾ ਹਾਂ ਉਹੀ ਸੀ ਨਾ ਵੀ ਚਲੋ ਆਪਾਂ ਵੀ ਵ ਵਧੀਆ ਐਜੂਕੇਸ਼ਨ ਹੋਵੇ ਵਧੀਆ ਮਾਹੌਲ ਹੋਵੇ ਨਾ ਵੀ ਚਲੋ ਕੇਅਰ ਹੋਵੇ ਬੱਚੇ ਦੀ ਸਟਾਫ ਵਧੀਆ ਹੋਵੇ ਨਾ

ਹਾਂ ਹਾਂ ਅੱਛਾ ਅੱਛਾ ਠੀਕ ਹੈ ਸ ਸਟਾਫ ਵਧੀਆ ਹਾਂ ਹਾਂ ਸਿੰਗਲ ਸਟਾਰ ਵਿੱਚ ਹੀ ਵਧੀਆ ਅੱਛਾ ਠੀਕ ਹੈ ਚਲੋ ਆਪਾਂ ਦੇਖ ਲਵਾਂਗੇ ਹਾਂ ਜਾ ਆਵਾਂਗੇ ਹਾਂ ਇੱਕ ਵਾਰੀ ਜਾ ਆਵਾਂਗੇ ਜਾ ਕੇ ਗੱਲ ਕਰ ਆਵਾਂਗੇ ਨਾਲੇ ਸਕੂਲ ਦੇਖ ਕੇ ਆਵਾਂਗੇ ਵੀ ਕਿੱਦਾਂ ਦਾ ਸਕੂਲ ਹੈ ਬਿਲਡਿੰਗ ਵਗੈਰਾ ਦੇਖ ਆਵਾਂਗੇ ਸਾਰਾ ਐਟਮੋਸਫੇਅਰ ਦੇਖ ਆਵਾਂਗੇ ਓਕੇ ਹਾਂ ਚਲੋ ਠੀਕ ਆ ਓਕੇ